ਵਿਹੜੇ ਜਾਂ ਬਾਗ ਵਿੱਚ ਪੰਛੀਆਂ ਨੂੰ ਆਕਰਸ਼ਿਤ ਕਰਨ ਲਈ ਕਈ ਤਰ੍ਹਾਂ ਦੇ ਸਝਾਅ ਅਪਣਾਏ ਜਾਂਦੇ ਹਨ ਜਿਸ ਤਰ੍ਹਾਂ ਬਾਗ ਵਿੱਚ ਅਸੀਂ ਆਪਣੇ ਦਰੱਖਤਾਂ 'ਤੇ ਉਹਨਾਂ ਨੂੰ ਬਣਾਵਟੀ ਆਲ੍ਹਣੇ ਦਿੰਦੇ ਹਾਂ ਜਿੰਨ੍ਹਾਂ ਵਿੱਚ ਉਹ ਆਣ ਕੇ ਆਪਣਾ ਆਲ੍ਹਣਾ ਬਣਾ ਕੇ ਕੱਖ ਰੱਖ ਕੇ ਉਹਦੇ ਵਿੱਚ ਬੱਚੇ ਆਂਡੇ ਦਿੰਦੇ ਹਨ ਉਸ ਤੋਂ ਬਾਅਦ ਜਾ ਆਪਣੇ ਬੱਚੇ ਪਾਲਦੇ ਹਨ ਫਿਰ ਉੱਥੇ ਹੀ ਜ਼ਿਆਦਾ ਘਣ ਵਾਲੇ ਜ਼ਿਆਦਾ ਸੰਘਣੇ ਰੁੱਖ ਜਿਹੜੇ ਨੇ ਉਹ ਲਾਏ ਜਾਂਦੇ ਹਨ ਸੰਘਣੇ ਰੁੱਖਾਂ ਵਿੱਚ ਉਹ ਆਪ ਵੀ ਆਲ੍ਹਣੇ ਪਾ ਕੇ ਬਹਿ ਜਾਂਦੇ ਨੇ ਜਾਂ ਜਾਂ ਕੇ ਉਹ ਜਿਹੜੇ ਜਿਹੜੇ ਉਹਨਾਂ ਨੂੰ ਜਿਹੜੇ ਪੰਛੀ ਜ਼ਿਆਦਾ ਉਹਨਾਂ ਨੂੰ ਖ਼ਤਰਾ ਖ਼ਤਰੇ ਵਾਲੇ ਪੰਛੀ ਕਈ ਹੁੰਦੇ ਨੇ ਜਿਹੜੇ ਉਹਨਾਂ ਨੂੰ ਖਾਂਦੇ ਹਨ ਜਾਂ ਉਹਨਾਂ ਨੂੰ ਬੱਚਿਆਂ ਨੂੰ ਖਾ ਜਾਂਦੇ ਨੇ ਉਹ ਉਹਨਾਂ ਤੋਂ ਬਿਲਕੁਲ ਹੀ ਲੁਕੇ ਰਹਿੰਦੇ ਹਨ ਇਸ ਤਰ੍ਹਾਂ ਅਸੀਂ ਸੰਘਣੇ ਰੁੱਖ ਲਾਏ ਹੋਏ ਨੇ ਫਿਰ ਛੱਤਾਂ ਉੱਪਰ ਵੀ ਆਪਾਂ ਵਿਹੜੇ ਵਿੱਚ ਜਿਸ ਤਰ੍ਹਾਂ ਛੱਤ ਉੱਪਰ ਜਾਂ ਵਿਹੜੇ ਵਿੱਚ ਉਹਨਾਂ ਲਈ ਅਸੀਂ ਅਨਾਜ ਖਲਾਰਦੇ ਹਾਂ ਜਿਸ ਤਰ੍ਹਾਂ ਬਾਜਰੇ ਨੂੰ ਕਬੂਤਰ ਜ਼ਿਆਦਾ ਪਸੰਦ ਕਰਦਾ ਹੈ ਇਹ ਕਣਕ ਪਾਈ ਜਾਂਦੀ ਹੈ ਜਾਂ ਮੱਕੀ ਦੇ ਉਹਨਾਂ ਨੂੰ ਪਿਆ ਕੇ ਕਟ ਮੱਕੀ ਜਿਹੜੀ ਉਹ ਪਾਈ ਜਾਂਦੀ ਹੈ ਹਾਂ ਅਸੀਂ ਆਪਣੇ ਪੰਛੀਆਂ ਲਈ ਅਸੀਂ ਆਪਣੇ ਵਿਹੜੇ ਵਿੱਚ ਪੰਛੀਆਂ ਲਈ ਅਨਾਜ ਅਤੇ ਪਾਣੀ ਜ਼ਰੂਰ ਰੱਖਦੇ ਹਾਂ ਤਾਂ ਜੋ ਪੰਛੀ ਆਣ ਕੇ ਉੱਥੇ ਆਣ ਕੇ ਛੱਤ ਉੱਪਰ ਬੈਠਦੇ ਹਨ ਜਾਂ ਵਿਹੜੇ ਵਿੱਚ ਵੀ ਦਾਣਾ ਖਲਾਰਦੇ ਹਨ ਛੱਤ 'ਤੇ ਵੀ ਰੱਖ ਦਿੰਦੇ ਹਨ ਪੰਛੀ ਆਣ ਕੇ ਪਾਣੀ ਅਤੇ ਅਨਾਜ ਪਾਣੀ ਪੀਂਦੇ ਅਤੇ ਅਨਾਜ ਖਾਂਦੇ ਹਨ